ਪੰਜ ਮਾਰਤ ਦੋ ਹਜ਼ਾਰ ਇੱਕ ਸੌਲਾਂ ਜੂਨ ਉੱਨੀ ਸੌ ਤਰਾਨਵੇਂ ਅੱਠ ਮਾਰਚ ਦੋ ਹਜ਼ਾਰ ਪੰਦਰਾਂ ਪੱਚੀ ਜੁਲਾਈ ਦੋ ਹਜ਼ਾਰ ਇੱਕੀ ਉਨੱਤੀ ਫਰਵਰੀ ਦੋ ਹਜ਼ਾਰ ਬਾਈ